ਹੈਲੋ ਹਾਂਜੀ ਹੈਲੋ

ਇਹ ਉਹਨੂੰ ਨਹੀਂ ਉਹਨੂੰ ਕੀ ਬੁਖਾਰ ਆ ਜਾਂ ਉਹ ਟੀਕਾ ਲੱਗੇ ਤੋਂ ਬਾਅਦ ਵੀ ਕੁਝ ਚਿਰ ਬਾਅਦ ਬੁਖਾਰ ਹੁੰਦਾ ਵੀ ਉਹਨੂੰ ਟੀਕਾ ਤਾਂ ਨੀ ਲਗਵਾਇਆ ਅੱਛਾ ਹੋਰ ਕੀ ਪ੍ਰੋਬਲਮ ਆ ਉਹਨੂੰ ਜਿਵੇਂ ਹੁਣ ਮੂੰਹ ਤੋਂ ਝੱਗ ਝੁਗ ਤਾਂ ਨੀ ਛੱਡਦਾ ਹੈਗਾ ਜਾਂ ਤਾਂ ਜਿਵੇਂ ਹੁਣ ਕੁੱਤਾ ਜਿਵੇਂ ਜੇਰ ਖਾਜੇ ਤਾਂ ਵੀ ਹਲਕ ਜਾਂਦਾ ਵਾ ਜਿਵੇਂ ਝੱਗ ਮੂੰਹ ਤੇ ਆਉਂਦੀ ਆ ਜਾਂ ਕਿਸੇ ਹਲਕੇ ਕੁੱਤੇ ਨੇ ਮੂੰਹ ਲਾ ਤਾ ਤਾਂ ਵੀ ਉਹਨੂੰ ਹਲਕਾਅ ਹੋ ਸਕਦਾ

ਉਹ ਬੁਖਾਰ ਹੁੰਦਾ ਕਰਕੇ ਬੁਖਾਰ ਕਰਕੇ ਪ੍ਰੋਬਲਮ ਆਉਂਦੀ ਆ ਉਹਨੂੰ ਟੈਂਪਰੇਚਰ ਹੁੰਦਾ ਵਾ ਉਹਦਾ ਇੱਕ ਵਰੀ ਨਪਿਆ ਜਾਵੇ ਟੈਂਪਰੇਚਰ ਵੀ ਬੁਖਾਰ ਕਿੰਨਾ ਕੁ ਹੁੰਦਾ ਉਹਨੂੰ ਤੇ ਉਸ ਤੋਂ ਬਾਅਦ ਫਿਰ ਉਹਨੂੰ ਦਵਾਈ ਦਿੱਤੀ ਜਾ ਸਕਦੀ ਉਹਦੇ ਨਾਲ ਠੀਕ ਹੋਜੁਗਾ ਬੁਖਰ ਨਹੀਂ ਤੁਸੀਂ ਸ਼ੌਪ ਤੇ ਲੈ ਕੇ ਆ ਜਾਓ ਤਾਂ ਬਾਲਾ ਵਧੀਆ ਵਾ ਉਥੇ ਆਪਾਂ ਉਹਨੂੰ ਟ੍ਰੀਟਮੈਂਟ ਦੇ ਦਿਆਂਗੇ ਉਹਦਾ ਬੁਖਾਰ ਵੀ ਚੈੱਕ ਕਰ ਲਾਂਗੇ ਉਹਦਾ ਬੁਖਾਰ ਕਿੰਨਾ ਰਹਿੰਦਾ ਉਹਨੂੰ ਤੁਸੀਂ ਸਵੇਰੇ ਦਸ ਤੋਂ ਲੈ ਕੇ ਸ਼ਾਮ ਨੂੰ ਚਾਰ ਵਜੇ ਤੱਕ ਕਿਸੇ ਟਾਈਮ ਵੀ ਆ ਜਾਓ ਤੇ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਹੋਰ ਕੋਈ ਪ੍ਰੋਬਲਮ ਆ ਉਹਨੂੰ ਕੋਈ ਉਹਨੂੰ ਇੱਕ ਨਾ ਪੈਰਾਸਟਾ ਮੂੰਹ ਗੋਲੀ ਆਉਂਦੀ ਆ ਉਹ ਘੋਲ ਕੇ ਦੇ ਦਿਓ ਜੇ ਬੁਖਾਰ ਹੋਇਆ ਬੁਖਾਰ ਠੀਕ ਹੋ ਜਾਊਗਾ ਹੋ ਸਕਦਾ ਉਹਦੇ ਅੰਦਰ ਇਨਫੈਕਸ਼ਨ ਹੋਵੇ ਉਹਦੇ ਕਰਕੇ ਪ੍ਰੋਬਲਮ ਜਿਆਦਾ ਆਉਂਦੀ ਆ ਤੇ ਆਪਾਂ ਨੂੰ ਫਿਰ ਇੰਜੈਕਸ਼ਨ ਵਗੈਰਾ ਦੇਣਾ ਪੈਣਾ ਜਾਂ ਉਹਦੇ ਡਰਿੱਪ ਵਗੈਰਾ ਲਾਉਣੀ ਪੈਣੀ ਆ ਉਹਦੇ ਨਾਲ ਉਹ ਸਹੀ ਹੋ ਸਕਦਾ ਵਾ ਉਹਨੂੰ ਕੋਈ ਨਾ ਪਤਲਾ ਕਰਕੇ ਨਾ ਦੁੱਧ ਨੂੰ ਪਾਓ ਪਤਲਾ ਕਰਕੇ ਥੋੜਾ ਕ ਘੱਟ ਪਾਓ ਦੁੱਧ ਪਾਓ ਰੋਟੀ ਉਹਨੂੰ ਬਿਲਕੁਲ ਨਾ ਖਾਣ ਨੂੰ ਦਿਓ ਤੇ ਉਹਨੂੰ ਕੇਲਾ ਵਗੈਰਾ ਵੀ ਥੋੜਾ ਕ ਦੇ ਸਕਦੇ ਆ ਤੇ ਥੋੜਾ ਕ ਉਹਨੂੰ ਹੋਰ ਪਾਣੀ ਜਿਵੇਂ ਹੈਗਾ ਵਾ ਥੋੜਾ ਉਬਾਲ ਕੇ ਠੰਡਾ ਕਰਕੇ ਪਾਣੀ ਵੀ ਉਹਨੂੰ ਪਿਆ ਸਕਦੇ ਓਕੇ